ਹੈਲੋ ਹਾਂ ਬਈ ਭੁਰੂ ਬਸ ਵਧੀਆ ਝੋਨਾ ਕੱਟ ਲਿਆ ਤੁਸੀਂ ਨਹੀਂ ਨਹੀਂ ਯਾਰ ਕੱਟਣਾ ਐਤਕੀਂ ਤਾਂ ਬੀਜ ਹੀ ਠੀਕ ਠਾਕ ਸੀ ਮਜ਼ਾ ਹੀ ਨਹੀਂ ਆਇਆ ਫਸਲ ਉੱਗੀ ਨਹੀਂ ਜ਼ਿਆਦਾ ਹਮ ਨਹੀਂ ਨਹੀਂ ਐੱਚ ਪੀ ਵਾਲੇ ਲਾਉਣ ਡਿਆਂ ਐਵੇਂ ਖਰਾਬ ਬਹੁਤ ਹੁੰਦੇ ਹੈ ਫਿਰ ਐਵੇਂ ਉੱਨੀ ਸੌ ਸੱਤਰ ਹੀ ਨਹੀਂ ਜਾਣਾ ਆਪਾਂ ਵਾਪਿਸ ਨਵੇਂ ਵਾਲੇ ਵਧੀਆ ਹੈ ਓਵੇਂ ਹੀ ਹਾਂ ਆਈ ਉਹ ਹਮ ਹਾਂਜੀ ਪਹਿਲਾਂ ਵੀ ਤਾਂ ਐਵੇਂ ਹੀ ਕਰਦੇ ਸੀ ਗਰੀਨ ਰੈਵੋਲਊਸ਼ਨ 'ਚ ਸ਼ੁਰੂ ਕੀਤਾ ਆਪਾਂ ਇਹ ਸਾਰਾ ਉਸ ਤੋਂ ਬਾਅਦ ਦੇਖ ਕਿੰਨੀ ਕਮਾਈ ਆਉਣ ਲੱਗ ਗਈ ਹਮ ਆਪਾਂ ਨੂੰ ਕੀ ਆਪਣੇ ਆਪਣੇ ਬੀਜ ਉੱਗੀ ਜਾਣ ਵਧੀਆ ਆਪਾਂ ਨੂੰ ਕਿਸੇ ਦਾ ਆਪਣੀ ਫਸਲ ਉੱਗ ਜਾਂਦੀ ਵਧੀਆ ਦੋ ਦੋ ਬੰਦੇ ਹੋਰ ਪਾ ਲਵਾਂਗੇ ਪੈਸਟੀਸਾਈਡ ਦੇ ਛਿੜਕ ਦੇਵਾਂਗੇ ਟੈਂਕ ਖਾਦ ਜ਼ਿਆਦਾ ਪਾ ਦਵਾਂਗੇ ਹੋਰ ਕੀ ਬੋਰ ਲੰਬਾ ਕਰ ਲਵਾਂਗੇ ਹੋਰ ਕੀ ਹੈ ਪਾਣੀ ਤਾਂ ਆ ਜਾਏਗਾ ਹਮ ਹਮ ਟਿਊਬਵੈੱਲ ਥੋੜ੍ਹਾ ਹੋਰ ਲੰਬਾ ਕਰ ਲਵਾਂਗੇ ਹਮ ਹਾਂ ਨਹੀਂ ਲੈ ਹਾਂ ਕੋਈ ਨਹੀਂ ਤਾਂ ਆਪਾਂ ਨੂੰ ਤਾਂ ਕਮਾਈ ਹੋਈ ਜਾਂਦੀ ਹੈ ਨਾਲੇ ਸਾਰੇ ਔਰਗੈਨਿਕ ਕਰਨ ਤਾਂ ਆਪਾਂ ਨੂੰ ਤਾਂ ਕਮਾਈ ਹੋਈ ਜਾਂਦੀ ਹੈ ਸਾਰੇ ਔਰਗੈਨਿਕ ਕਰਨ ਲੱਗ ਗਏ ਤਾਂ ਫਿਰ ਸਾਰੇ ਭੁੱਖੇ ਮਰਨਗੇ ਇੰਨੇ ਲੋਕਾਂ ਨੂੰ ਔਰਗੈਨਿਕ ਬੜੀ ਇਹ ਤਾਂ ਜਦੋਂ ਹਮ ਮਿੱਟੀ ਤਾਂ ਖਰਾਬ ਹੋਈ ਜਾਂਦੀ ਆ ਰੋਜ਼ ਹਰ ਸਾਲ ਜ਼ਿਆਦਾ ਤੋਂ ਜ਼ਿਆਦਾ ਹਮ ਹਮ ਹਮ ਚੱਲ ਠੀਕ ਹੈ